ਆਨਲਾਈਨ ਸਕੂਲਿੰਗ ਅਤੇ ਕੋਚਿੰਗ ਨੇ ਟੈਕਨੋਲਜੀ ਦੁਆਰਾ ਵਿਦਿਆਰਥੀਆਂ ਨੂੰ ਨਵੀਆਂ ਸਿੱਖਣ ਦੀਆਂ ਸੰਭਾਵਨਾਵਾਂ ਦਿੱਤੀਆਂ ਹਨ ਵਿਸ਼ੇਸ਼ ਤੌਰ 'ਤੇ ਕੋਵਿਡ ਨਾਈਨਟੀਨ ਮਹਾਂਮਾਰੀ ਦੌਰਾਨ ਜਾਂ ਸਕੂਲ ਅਤੇ ਕੋਚਿੰਗ ਸੈਂਟਰ ਬੰਦ ਸਨ ਤੱਦ ਇਹ ਤਕਨੀਕ ਇੱਕ ਵੱਡਾ ਆਸ਼ੀਰਵਾਦ ਬਣੀ ਜੂਮ ਗੂਗਲ ਮੀਟ ਅਤੇ ਹੋਰ ਆਨਲਾਈਨ ਪਲੈਟਫਾਰਮਾਂ ਨੇ ਵਿਦਿਆਰਥੀ ਨੂੰ ਘਰ ਬੈਠੇ ਹੀ ਪੜ੍ਹਨ ਦੀ ਸਹੂਲਤ ਦਿੱਤੀ ਪਰ ਇਸ ਦੇ ਆਪਣੇ ਵਧੀਆ ਅਤੇ ਨੁਕਸਾਨ ਦਾਇਕ ਪ੍ਰਭਾਵ ਵੀ ਹਨ ਇਹਦੇ ਵਿੱਚ ਜਿਵੇਂ ਚੰਗੇ ਪ੍ਰਭਾਵ ਹਨ ਸਮੇਂ ਦੀ ਬਚਤ ਨਵੀਆਂ ਤਕਨੀਕਾਂ ਨਾਲ ਪੜ੍ਹਾਈ ਵਿਦੇਸ਼ੀ ਅਤੇ ਦੂਰ ਦੇ ਟੀਚਰਾਂ ਨਾਲ ਸਿੱਖਣ ਦਾ ਮੌਕਾ ਆਤਮ ਨਿਰਭਰਤਾ ਹੁਣ ਬੱਚਿਆਂ ਨੂੰ ਯਾਤਰਾ ਕਰਨ ਦੀ ਲੋੜ ਨਹੀਂ ਪੈਂਦੀ ਜਿਸ ਨਾਲ ਉਹ ਜ਼ਿਆਦਾ ਸਮਾਂ ਪੜ੍ਹਾਈ ਅਤੇ ਹੋਰ ਸਮਗਰੀਆਂ ਉੱਤੇ ਬਿਤਾ ਸਕਦੇ ਹਨ ਉਹ ਇਸ ਸਮੇਂ ਵਿੱਚ ਹੋਰ ਵੀ ਕਈ ਚੀਜ਼ਾਂ ਪੜ੍ਹ ਸਕਦੇ ਹਨ ਨਵੀਆਂ ਤਕਨੀਕਾਂ ਨਾਲ ਪੜ੍ਹਾਈ ਕਰ ਸਕਦੇ ਹਨ ਵੀਡੀਓ ਐਨੀਮੇਸ਼ਨ ਅਤੇ ਇੰਟਰੈਕਟਿਵ ਮਡਿਊਲ ਬੱਚਿਆਂ ਦੇ ਸਿੱਖਣ ਦਾ ਇੱਕ ਨਵਾਂ ਤਰੀਕਾ ਬਣ ਗਿਆ ਦੂਰ ਦੇ ਟੀਚਰਾਂ ਨਾਲ ਵੀ ਮਿਲਣ ਦਾ ਇੱਕ ਖਾਸ ਮੌਕਾ ਮਿਲਿਆ ਕੋਈ ਵੀ ਵਿਅਕਤੀ ਵਿਦੇਸ਼ੀ ਕੋਚਿੰਗ ਜਾਂ ਵਧੀਆ ਅਧਿਆਪਕ ਤੋਂ ਘਰ ਬੈਠੇ ਹੀ ਸਿੱਖ ਸਕਦਾ ਹੈ ਉਸ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਆਤਮਿਕ ਨਿਰਭਰਤਾ ਆਨਲਾਈਨ ਸਿੱਖਣ ਨਾਲ ਬੱਚਿਆਂ ਵਿੱਚ ਖੁਦ ਨਿਰਭਰ ਬਣਨ ਅਤੇ ਆਤਮ ਅਨੁਸ਼ਾਸਨ ਜੋ ਹੈ ਪੈਦਾ ਹੋਣ ਲੱਗ ਪਿਆ ਹੁਣ ਇਸ ਦੇ ਕੁਛ ਨਾਕਾਰਤਮਕ ਅਤੇ ਨਾ ਨੈਗਟਿਵ ਪ੍ਰਭਾਵ ਵੀ ਹਨ ਜਿਵੇਂ ਧਿਆਨ ਪਾਠ ਕਰਨ ਦਾ ਖਤਰਾ ਸਮਾਜਿਕ ਸਲਾਹ ਮਸ਼ਵਰਾ ਘੱਟ ਜਾਣਾ ਸਿਹਤ ਦੀਆਂ ਸਮੱਸਿਆਵਾਂ ਅਭਿਆਸ ਦੀ ਘਾਟ ਅਤੇ ਆਪਸੀ ਤਾਲਮੇਲ ਵੀ ਘੱਟ ਜਾਂਦਾ ਹੈ ਧਿਆਨ ਭਟਕਣ ਦੇ ਕਰਕੇ ਘਰ ਵਿੱਚ ਆਸ ਪਾਸ ਖੇਡਣ ਦੇ ਆਕਰਸ਼ਣ ਮੋਬਾਈਲ ਗੇਮ ਅਤੇ ਹੋਰ ਗੱਲਾਂ ਦਾ ਧਿਆਨ ਭਟਕਣ ਦਾ ਖਤਰਾ ਰਹਿੰਦਾ ਹੀ ਹੈ ਸਮਾਜਿਕ ਜੋ ਹੈ ਸਕੂਲ ਵਿੱਚ ਕੋਚਿੰਗ ਵਿੱਚ ਵਿਦਿਆਰਥੀ ਆਪਣੇ ਦੋਸਤਾਂ ਨਾਲ ਮਿਲ ਕੇ ਸਿਖਦੇ ਹਨ ਜੋ ਕਿ ਆਨਲਾਈਨ ਵਿੱਚ ਨਹੀਂ ਸਿੱਖਿਆ ਜਾਂਦਾ ਲੰਬੇ ਸਮੇਂ ਤੱਕ ਸਕਰੀਨ ਦੇ ਸਾਹਮਣੇ ਬੈਠਣ ਨਾਲ ਅੱਖਾਂ ਪਿੱਠ ਅਤੇ ਮਾਨਸਿਕ ਤਨਾਅ ਵੀ ਹੋ ਸਕਦਾ ਹੈ ਸੋ ਇਸ ਦੀ ਵਰਤੋਂ ਇੱਕ ਸੰਤੁਲਿਤ ਤਰੀਕੇ ਨਾਲ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਆਨਲਾਈਨ ਅਤੇ ਆਫਲਾਈਨ ਪੜ੍ਹਾਈ ਵਿੱਚਕਾਰ ਇੱਕ ਬੈਲੈਂਸ ਰੱਖਣਾ ਚਾਹੀਦਾ ਹੈ